ਜੇਕਰ ਕੋਈ ਵਿਅਕਤੀ ਪੇਂਟਿੰਗ ਦੀ ਸ਼ੁਰੂਆਤ ਕਰਨਾ ਚਾਹੁੰਦਾ ਹੈ ਤਾਂ ਮੇਰੀ ਉਸ ਨੂੰ ਪਹਿਲੀ ਸਲਾਹ ਇਹ ਹੈ ਕਿ ਉਸ ਨੂੰ ਰੰਗਾਂ ਦੀ ਪਹਿਚਾਣ ਹੋਵੇ ਅਤੇ ਰੰਗਾਂ ਤੋਂ ਅਲੱਗ ਅਲੱਗ ਹੋਰ ਵੀ ਜਿਹੜੇ ਕੋਂਬੀਨੇਸ਼ਨ ਕੀਤੇ ਜਾਂਦੇ ਹੈ ਰੰਗ ਤੋਂ ਰੰਗ ਕਿਵੇਂ ਬਣਾਏ ਜਾਂਦੇ ਹੈ ਉਹਨਾਂ ਦੇ ਬਾਰੇ ਪਤਾ ਹੋਵੇ ਉਸ ਤੋਂ ਬਾਅਦ ਉਸ ਨੂੰ ਪੈਂਸਲ ਚਲਾਉਣ ਦਾ ਅਤੇ ਪੈਂਸਲ ਦੇ ਨਾਲ ਡਰਾਇੰਗ ਕਰਨ ਅਤੇ ਈਰੇਜ਼ਰ ਦੇ ਨਾਲ ਉਸ ਨੂੰ ਇੱਕ ਸੋਹਣੀ ਅਤੇ ਸੁੰਦਰ ਸ਼ੇਪ ਦੇਣ ਦੇ ਬਾਰੇ ਗਿਆਨ ਹੋਵੇ ਇਸ ਤੋਂ ਬਾਅਦ ਉਸ ਦੇ ਲਈ ਉਸਦੇ ਕੋਲ ਆਪਣੇ ਰੰਗ ਆਪਣੇ ਪੇਂਟ ਕਰਨ ਦੇ ਲਈ ਬ੍ਰਸ਼ ਅਤੇ ਆਪਣਾ ਸਾਰਾ ਸਮਾਨ ਹੋਵੇ ਤਾਂ ਜੋ ਉਸ ਨੂੰ ਡਰਾਇੰਗ ਜਾਂ ਪੇਂਟਿੰਗ ਕਰਦਿਆਂ ਹੋਇਆਂ ਕਿਸੇ ਤੋਂ ਵੀ ਸਮਾਨ ਲੈਣ ਦੀ ਲੋੜ ਨਾ ਪਵੇ ਪੇਂਟਿੰਗ ਦੇ ਵਿੱਚ ਜਦੋਂ ਉਹ ਆਪਣੀ ਇੱਕ ਡਰਾਇੰਗ ਕੰਪਲੀਟ ਕਰ ਲੈਂਦਾ ਉਸ ਵਿੱਚ ਉਹ ਜਦੋਂ ਰੰਗ ਭਰੇ ਰੰਗ ਭਰਨ ਦੇ ਲਈ ਉਸ ਕੋਲ ਅਲੱਗ ਅਲੱਗ ਸ਼ੇਪਸ ਦੇ ਅਲੱਗ ਅਲੱਗ ਸਾਈਜ਼ ਦੇ ਬ੍ਰਸ਼ ਹੋਣੇ ਜ਼ਰੂਰੀ ਹਨ ਕਿਉਂਕਿ ਡਰਾਇੰਗ ਦੇ ਵਿੱਚ ਕਈ ਬਰੀਕੀ ਥਾਵਾਂ ਹੁੰਦੀਆਂ ਹਨ ਜਿਹਨਾਂ ਨੂੰ ਪਤਲੇ ਬ੍ਰਸ਼ਾਂ ਦੇ ਨਾਲ ਭਰਿਆ ਜਾਂਦਾ ਹੈ ਇਸ ਤੋਂ ਬਾਅਦ